ਹੈਲੋ ਹਾਂਜੀ ਨਮਸਤੇ ਜੀ ਹਾਂਜੀ ਸਾਡੇ ਇੱਥੇ ਪਾਣੀ ਦੀ ਸਪਲਾਈ ਦਾ ਕੋਈ ਉਹ ਨਹੀਂ ਹੈ ਪਾਣੀ ਦੀ ਕੋਈ ਦਿੱਕਤ ਨਹੀਂ ਹੈ ਸਾਡੇ ਸ਼ਹਿਰ ਵਿੱਚ ਸਪਲਾਈ ਬਹੁਤ ਅੱਛੀ ਹੈ ਪਾਣੀ ਦੀ ਤਿੰਨ ਟਾਈਮ ਪਾਣੀ ਆਉਂਦਾ ਸਾਡੇ ਇੱਥੇ ਅਤੇ ਸਵੇਰੇ ਆਉਂਦਾ ਛੇ ਵਜੇ ਤੋਂ ਲੈ ਕੇ ਨੌਂ ਵਜੇ ਤੱਕ ਦੁਪਹਿਰੇ ਪਾਣੀ ਸਾਡੇ ਆਉਂਦਾ ਬਾਰਾਂ ਵਜੇ ਤੋਂ ਲੈ ਤਿੰਨ ਵਜੇ ਤੱਕ ਔਰ ਰਾਤੀ ਸਾਡੇ ਪਾਣੀ ਆਉਂਦਾ ਸ਼ਾਮੀ ਪੰਜ ਵਜੇ ਤੋਂ ਲੈ ਕੇ ਰਾਤੀ ਨੌਂ ਵਜੇ ਤੱਕ ਸਾਡੇ ਇੱਥੇ ਪਾਣੀ ਦੀ ਕੋਈ ਦਿੱਕਤ ਨਹੀਂ ਪਾਣੀ ਦੀ ਸਪਲਾਈ ਇੱਥੇ ਪਠਾਨਕੋਟ ਏਰੀਏ ਵਿੱਚ ਬਹੁਤ ਅੱਛੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਪਾਣੀ ਦਾ ਬਿੱਲ ਆਉਂਦਾ ਜੀ ਪਾਣੀ ਦਾ ਬਿੱਲ ਸਾਨੂੰ ਵਾਟਰ ਸਪਲਾਈ ਵੱਲੋਂ ਆਉਂਦਾ ਜੀ ਕਮੇਟੀ ਘਰ ਵੱਲੋਂ ਔਰ ਦੋ ਮਹੀਨੇ ਦਾ ਬਿੱਲ ਮੇਰਾ ਆਉਂਦਾ ਸਾਢੇ ਛੇ ਸੌ ਰੁਪਿਆ ਜੀ ਹਾਂਜੀ ਪਾਣੀ ਦੀ ਪਠਾਨਕੋਟ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਮਿਲੇਗੀ ਜੀ ਹਾਂਜੀ ਹਾਂਜੀ ਪਾਣੀ ਵੀ ਤੁਹਾਨੂੰ ਸੀਵਰੇਜ ਦਾ ਔਰ ਪਾਣੀ ਦਾ ਇਕੱਠਾ ਬਿੱਲ ਆਂਦਾ ਜੀ ਅਤੇ ਇਹਦੀ ਤੁਹਾਨੂੰ ਕੋਈ ਕੰਪਲੇਂਟ ਨਹੀਂ ਹੈ ਪਾਣੀ ਦੀ ਪਠਾਨਕੋਟ ਏਰੀਆ ਵਿੱਚ ਪਾਣੀ ਦੀ ਕੋਈ ਕੰਪਲੇਂਟ ਨਹੀਂ ਹੈ ਜੀ ਕਿਉਂਕਿ ਸਾਡੇ ਏਰੀਏ ਵਿੱਚ ਦੋ ਜਗ੍ਹਾ ਤੋਂ ਪਾਣੀ ਆਉਂਦਾ ਜੀ ਸਾਡੇ ਐਮ ਸੀ ਜੀ ਨੇ ਦੋ ਜਗ੍ਹਾ ਦਾ ਪਾਣੀ ਸਪਲਾਈ ਇੱਥੇ ਹਾਂਜੀ ਠੀਕ ਹੈ ਥੈਂਕ ਯੂ